ਸਤਿ ਸ਼੍ਰੀ ਅਕਾਲ ਜੀ ਸਵੀਗੀ ਤੋਂ ਗੱਲ ਕਰ ਰਹੇ ਹੋ ਜੀ ਮੈਂ ਗੁਰਵਿੰਦਰ ਸਿੰਘ ਬੋਲ ਰਿਹਾ ਬਠਿੰਡਾ ਹਾਂ ਨਰੂਣਾ ਰੋਡ ਤੋਂ ਜੀ ਕੱਲ੍ਹ ਇੱਕ ਬਰਡੇ ਪਾਰਟੀ ਸੀ ਸਾਡੇ ਅਸੀਂ ਕੁਝ ਖਾਣ ਪੀਣ ਨਾਲ ਸਮਾਨ ਔਡਰ ਕੀਤਾ ਸੀ ਹਾਂ ਉਹਦੇ ਵਿੱਚ ਪੀਜ਼ਾ ਸੀ ਚਿਕਨ ਫਰਾਈ ਸੀ ਨਾਨ ਸੀਗੇ ਹਾਂ ਮੈਮ ਇਹ ਹੀ ਚੀਜ਼ਾਂ ਸੀਗੀਆਂ ਬਟ ਸਾਡਾ ਫੰਕਸ਼ਨ ਤਾਂ ਸ਼ੁਰੂ ਚਾਰ ਵਜੇ ਹੋਇਆ ਜੀ ਆਪਣਾ ਜਿਹੜਾ ਸਮਾਨ ਡਲੀਵਰ ਹੋਇਆ ਛੇ ਵਜੇ ਤਾਂ ਮੈਡਮ ਜਦੋਂ ਸਮਾਨ ਪਹੁੰਚਿਆ ਦੇਖਿਆ ਖੋਲ੍ਹ ਕੇ ਤਾਂ ਉਹ ਬਾਸਾ ਹੋ ਚੁੱਕਿਆ ਸੀ ਚੀੜਾ ਜਿਹਾ ਹੋ ਚੁੱਕਿਆ ਸੀ ਖਾਣ ਦੇ ਕਾਬਿਲ ਵੀ ਨਹੀਂ ਸੀ ਮੈਂ ਤਾਂ ਹੁਣ ਇਹ ਪੁੱਛਣਾ ਚਾਹੁੰਦਾ ਵੀ ਇਹ ਸਮਾਨ ਅਸੀਂ ਵਾਪਿਸ ਕਰਨਾ ਜੀ ਹੁਣ ਸਾਡੇ ਕਿਸੇ ਕੰਮ ਦਾ ਨਹੀਂ ਕਿਉਂਕਿ ਅਸੀਂ ਪਹਿਲਾਂ ਹੀ ਸਮਾਨ ਅਰੇਂਜ ਕਰ ਲਿਆ ਤੁਹਾਡਾ ਸਮਾਨ ਡਲੀਵਰੀ ਲੇਟ ਪਹੁੰਚੀ ਸਾਡੇ ਕੋਲ ਤਾਂ ਅਸੀਂ ਅਰੇਂਜ ਕਿਤੋ ਹੋਰ ਕੀਤਾ ਮਹਿਮਾਨ ਆਏ ਹੋਏ ਸੀ ਹਾਂ ਮੈਂ ਇਹ ਹੀ ਕਹਿਣਾ ਵੀ ਅਸੀਂ ਇਹਨੂੰ ਵਾਪਿਸ ਕਰਨਾ ਚਾਹੁੰਦੇ ਹਾਂ ਸਾਨੂੰ ਇਹਦੀ ਵਾਪਿਸ ਕਰਨ ਦੀ ਪ੍ਰਕਿਰਿਆ ਦੱਸੋ ਅਤੇ ਕਿੰਨੇ ਪ੍ਰਤੀਸ਼ਤ ਸਾਨੂੰ ਇਹਦਾ ਰਿਫੰਡ ਵਾਪਸੀ ਦਾ ਮਿਲੇਗਾ ਅਤੇ ਇਹਦੇ ਪੂਰੀ ਪ੍ਰਕਿਰਿਆ ਕੀ ਹੈ ਕਿਉਂਕਿ ਇਹ ਸਮਾਨ ਸਾਡੇ ਤਾਂ ਵੇਸਟ ਹੀ ਜਾਣਾ ਜੀ ਹਾਂਜੀ ਹਾਂਜੀ ਹਾਂਜੀ ਏ ਵਨ ਏ ਵਨ ਰੈਸਟੋਰੈਂਟ ਆ ਉੱਥੋਂ ਤੁਹਾਡੀ ਡਿਲੀਵਰੀ ਚੁੱਕੀ ਸੀ ਹਾਂ ਪਲੀਜ਼ ਦੱਸੋ ਜੀ